ਹੈਲੋ ਹਾਂਜੀ ਸਰ ਐਂ ਕੋ ਤੁਹਾਡੇ ਕੋਲੋਂ ਦਾਲ ਮੱਖਣੀ ਮੰਗਾਈ ਸੀ ਅਤੇ ਤੁਹਾਡੇ ਰੈਸਟੋਰੈਂਟ ਨੂੰ ਮੈਂ ਬੜੀ ਦੇਰ ਤੋਂ ਸੁਣ ਰਿਹਾ ਸੀ ਵੀ ਬਹੁਤ ਅੱਛਾ ਹੈ ਪਰ ਕੋਈ ਗੱਲ ਨਹੀਂ ਕਈ ਵਾਰੀ ਗਲਤੀ ਵੀ ਹੋ ਜਾਂਦੀ ਹੈ ਜਦੋਂ ਮੈਂ ਉਹਨੂੰ ਖੋਲਿਆ ਤਾਂ ਉਹਦੇ ਵਿੱਚੋਂ ਭਿੰਡੀ ਅਤੇ ਆਲੂ ਉਹਦੀ ਸਬਜ਼ੀ ਨਿਕਲੀ ਹੈ ਚੇ ਦੇ ਮੈਨੂੰ ਬੜਾ ਉਹ ਅਚੰਬਾ ਜਿਹਾ ਲੱਗਿਆ ਕਿਉਂਕਿ ਮੈਂ ਤਾਂ ਦਿੱਤਾ ਸੀ ਆਪਣਾ ਦਾਲ ਮੱਖਣੀ ਦਾ ਔਡਰ ਦਿੱਤਾ ਸੀ ਅਤੇ ਹੁਣ ਕਿਰਪਾ ਕਰਕੇ ਤੂੰ ਔਡਰ ਨੂੰ ਕੈਂਸਲ ਕਰੋ ਅਤੇ ਜਿਹੜਾ ਮੇਰਾ ਔਡਰ ਹੈ ਉਹ ਮੈਨੂੰ ਭੇਜ ਦਿਓ ਜੇ ਤੁਸੀਂ ਮੇਰੇ ਔਡਰ ਨੂੰ ਨਹੀਂ ਭੇਜ ਸਕਦੇ ਤਾਂ ਕਿਰਪਾ ਕਰਕੇ ਮੈਂ ਤੁਹਾਨੂੰ ਆਹ ਲਿੰਕ ਭੇਜ ਰਿਹਾ ਇਹਦੇ ਉੱਤੇ ਮੇਰਾ ਜਿਹੜਾ ਔਡਰ ਤ ਪੈਸਾ ਹੈ ਉਹ ਵਾਪਸ ਭੇਜ ਦਿਓ ਬਹੁਤ ਬਹੁਤ ਮਿਹਰਬਾਨੀ ਹੋਵੇਗੀ